ਲੋਕ ਗੀਤਾਂ ਵਿੱਚੋਂ ਮੈਨੂੰ ਮਿਰਜ਼ਾ ਸਭ ਤੋਂ ਜ਼ਿਆਦਾ ਪਸੰਦ ਹੈ ਇਸਦਾ ਕਾਰਨ ਹੈ ਕਿ ਇਸ ਦੇ ਵਿੱਚ ਮਿਠਾਸ ਅਤੇ ਰਾਗ ਬਹੁਤ ਹੀ ਵਧੀਆ ਹੈ ਮੈਂ ਕਦੇ ਇਹ ਖ਼ਾਸ ਗਾਇਆ ਤਾਂ ਨਹੀਂ ਕਿਉਂਕਿ ਮੇਰੀ ਆਵਾਜ਼ ਕੋਈ ਖ਼ਾਸ ਅੱਛੀ ਨਹੀਂ ਪਰ ਮੈਂ ਇਸ ਮਿਰਜ਼ੇ ਨੂੰ ਗਾਉਣ ਦੀ ਬੜੀ ਵਾਰ ਕੋਸ਼ਿਸ਼ ਕੀਤੀ ਹੈ ਕਿਉਂਕਿ ਮੈਨੂੰ ਇਹ ਬਹੁਤ ਅੱਛਾ ਲੱਗਦਾ ਹੈ ਔਰ ਅੱਛਾ ਕਿਉਂ ਲੱਗਦਾ ਕਿਉਂਕਿ ਮੈਂ ਜਦੋਂ ਛੋਟਾ ਸੀ ਬਚਪਨ ਦੇ ਵਿੱਚ ਮੇਰੇ ਪਿਤਾ ਜੀ ਮਿਰਜ਼ਾ ਗਾਇਆ ਕਰਦੇ ਸਨ ਘਰ ਵਿੱਚ ਅਤੇ ਮੈਂ ਉਹ ਸੁਣਦਾ ਹੁੰਦਾ ਸੀ ਹੁਣ ਵੀ ਜਦੋਂ ਮੈਂ ਮਿਰਜ਼ਾ ਸੁਣਦਾ ਹਾਂ ਤਾਂ ਮੈਨੂੰ ਆਪਣੇ ਪਿਤਾ ਜੀ ਦੀ ਯਾਦ ਆ ਜਾਂਦੀ ਹੈ